ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਏਜੰਸੀ 'ਚੋਂ ਬੋਲਦੇ ਆ ਅਸੀਂ ਤੁਹਾਡੇ ਕੋਲ ਗੱਡੀ ਚੈੱਕ ਕਰਾ ਬੁੱਕ ਕਰਵਾਈ ਸੀ ਅਤੇ ਗੱਡੀ ਸਾਡੇ ਕੋਲ ਹਜੇ ਨਹੀਂ ਪਹੁੰਚੀ ਬਹੁਤ ਟੈਮ ਤੋਂ ਬੇਟੈਮ ਹੋ ਗਏ ਤੇ ਸਾਨੂੰ ਤੁਸੀਂ ਅਸੀਂ ਸਹੀ ਟੈਮ 'ਤੇ ਗੱਡੀ ਸਾਡੀ ਪਹੁੰਚੂਗੀ ਹਜੇ ਤੱਕ ਪਹੁੰਚੀ ਨਹੀਂ ਜੇ ਤਾਂ ਟੈਮ 'ਤੇ ਪਹੁੰਚ ਸਕਦੀ ਆ ਗੱਡੀ ਪੰਦਰਾਂ ਵੀਹ ਮਿੰਟਾਂ ਦੀ ਅਸੀਂ ਹੋਰ ਵੇਟ ਕਰ ਸਕਦੇ ਹਾਂ ਉਹ ਤੋਂ ਵੱਖ ਅਸੀਂ ਆਪਣੀ ਨਹੀਂ ਗੱਡੀ ਹੋਰ ਕਰਵਾ ਕੇ ਅਤੇ ਅਸੀਂ ਬਠਿੰਡੇ ਤੋਂ ਲੁਧਿਆਣਾ ਪਹੁੰਚਣਾ ਸੀ ਅਤੇ ਸਾਡੇ ਕੋਲ ਬਹੁਤ ਘੱਟ ਟੈਮ ਰਹਿ ਗਿਆ ਅਤੇ ਅਸੀਂ ਸਾਨੂੰ ਬਹੁਤ ਮੁਸ਼ਕਿਲਾਂ ਆਉਣਗੀਆਂ ਇਸ ਵੇਟ ਦੇ ਵਿੱਚ ਜੇ ਤੁਸੀਂ ਗੱਡੀ ਨਹੀਂ ਪਹੁੰਚ ਸਕ ਭੇਜ ਸਕਦੇ ਅਤੇ ਅਸੀਂ ਗੱਡੀ ਹੋਰ ਕਰਵਾ ਲੈਂਦੇ ਹਾਂ ਅਤੇ ਅਸੀਂ ਆਪਣਾ ਉਸ ਗੱਡੀ 'ਤੇ ਪਹੁੰਚਾਂਗੇ ਫਿਰ ਤੁਸੀਂ ਇਤਰਾਜ਼ ਨਾ ਕਰਿਓ ਅਤੇ ਸਾਨੂੰ ਗੱਡੀ ਅਸੀਂ ਲੇਟ ਹੋ ਗਏ ਮੁਸ਼ਕਿਲਾਂ ਸਾਨੂੰ ਰਾਹ ਦੇ ਵਿੱਚ ਲੇਟ ਹੋਣ ਕਰਕੇ ਗੱਡੀ 'ਤੇ ਸਾਨੂੰ ਮੁਸ਼ਕਿਲਾਂ ਆਉਂਦੀਆਂ ਰਹਿਣਗੀਆਂ ਇਸ ਕਰਕੇ ਅਸੀਂ ਆਪਣੀ ਗੱਡੀ ਹੋਰ ਕਰਵਾ ਸਕਦੇ ਹਾਂ ਜੇ ਤੁਸੀਂ ਗੱਡੀ ਟੈਮ 'ਤੇ ਭੇਜ ਸਕਦੇ ਹੋ ਤਾਂ ਸਾਨੂੰ ਛੇਤੀ ਤੋਂ ਛੇਤੀ ਦੱਸ